ਹੈਲੋ ਸਤਿ ਸ਼੍ਰੀ ਅਕਾਲ ਜੀ ਜਲ ਸੇਵਾ ਕੇਂਦਰ ਤੋਂ ਬੋਲਦੇ ਹੋ ਮੈਂ ਤਨਵੀਰ ਫੇਸ ਟੂ ਡੁਗਰੀ ਤੋਂ ਬੋਲ ਰਿਹਾ ਹਾਂ ਮੈਂ ਇੱਕ ਦਿੱਕਤ ਦਾ ਸਾਹਮਣਾ ਕਰ ਰਿਹਾ ਹਾਂ ਮੈਂ ਸਵੇਰੇ ਆਪਣੇ ਪਲਾਟ ਦੇ ਵਿੱਚ ਪਾਣੀ ਦਿੰਦੇ ਸਮੇਂ ਮੈਂ ਇੱਕ ਚੀਜ਼ ਦੇਖਦਾ ਹਾਂ ਕਿ ਉਹ ਮੇਰੇ ਪਲਾਟ ਦੇ ਵਿੱਚ ਇੱਕ ਡੂੰਘਾ ਖੱਡਾ ਅੰਦਰ ਨੂੰ ਧੱਸ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਥੱਲੇ ਸੀਵਰੇਜ ਪਾਈਪਾਂ ਪਈਆਂ ਹੋਈਆਂ ਹੈ ਉਹ ਖਰਾਬ ਹੋ ਗਈ ਹੈ ਜਿਹਦੇ ਕਰਕੇ ਕੀ ਹੈ ਜਿਹੜੀ ਉੱਥੇ ਦੀ ਜ਼ਮੀਨ ਹੈ ਉਹ ਧੱਸਣੀ ਸ਼ੁਰੂ ਹੋ ਗਈ ਹੈ ਉੱਥੇ ਇੱਕ ਛੋਟਾ ਜਿਹਾ ਖੱਡਾ ਬਣ ਗਿਆ ਹੈ ਅਤੇ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਆ ਕੇ ਆਹ ਜਿਹੜਾ ਖੱਡਾ ਹੋਇਆ ਹੈ ਉਹਨੂੰ ਕਿਰਪਾ ਕਰਕੇ ਉਹਦੀ ਜਾਂਚ ਪੜਤਾਲ ਅੱਗੇ ਉਹਦਾ ਜੋ ਵੀ ਤੁਸੀਂ ਕਾਰਵਾਈ ਕਰਨੀ ਹੈ ਉਹ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਅੱਗੇ ਜਾ ਕੇ ਸਮੱਸਿਆ ਨਾ ਆਵੇ ਕਿਉਂਕਿ ਇਹਦੇ ਕਰਕੇ ਜੇ ਇਹਦੇ ਉੱਤੇ ਕੋਈ ਤੁਰਦਾ ਹੈ ਜਾਂ ਕੋਈ ਮਤਲਬ ਕਿਸੇ ਨੇ ਅਗਰ ਕੋਈ ਪਾਣੀ ਦਿੰਦਾ ਹੋਇਆ ਜਾਂ ਕੋਈ ਖੇਡਦਾ ਹੋਇਆ ਕੋਈ ਬੱਚਾ ਡਿੱਗ ਗਿਆ ਤਾਂ ਉਹ ਫਿਰ ਅੱਗੇ ਜਾ ਕੇ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਉਹਨਾਂ ਦੇ ਕਈ ਵਾਰੀ ਸੱਟ ਵੀ ਲੱਗ ਸਕਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਜੋ ਖੱਡਾ ਮੇਰੇ ਘਰ ਦੇ ਕੋਲ ਬਣ ਰਿਹਾ ਹੈ ਆ ਕੇ ਇਹਦੀ ਜਲਦੀ ਤੋਂ ਜਲਦੀ ਇਹਦੀ ਤੁਸੀਂ ਜਾਂਚ ਪੜਤਾਲ ਕਰ ਲਓ ਜੀ